ਮੈਂ ਨਵਾਂਸ਼ਹਿਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਸਾਡੇ ਲਾਗੇ ਹੀ ਨਵਾਂਸ਼ਹਿਰ ਵਿੱਚ ਹੀ ਇੱਕ ਬਹੁਤ ਵਧੀਆ ਮੇਲਾ ਹੋਇਆ ਸੀਗਾ ਜਿਸ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਿਆਂ ਹੱਥਾਂ ਨਾਲ ਬਣਾਈਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਦਿਖਾਇਆ ਸੀਗਾ ਜਿਵੇਂ ਕਿ ਆਪਾਂ ਗੱਲ ਕਰੀਏ ਅਤੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਲੱਕੜੀ ਦੇ ਬਣ ਜਿਹੜੇ ਆ ਕੜੇ ਵਗੈਰਾ ਜਾਂ ਆਪਣੇ ਹਾਰ ਦਾ ਸ਼ਿ ਹਾਰ ਸ਼ਿੰਗਾਰ ਦੇ ਸਮਾਨ ਬਣਾਏ ਸੀਗੇ ਜਿਹਦੇ ਵਿੱਚ ਉਹਨਾਂ ਨੇ ਹੋਰ ਵੀ ਕਈ ਜਿਵੇਂ ਹੱਥਾਂ ਹੱਥਾਂ ਦੇ ਬਣਾਏ ਹੋਰ ਵੀ ਕਈ ਸਮਾਨ ਜਿਹੜੇ ਕਿ ਉੱਥੇ ਦਿਖਾਏ ਜਿਹਨਾਂ ਨੂੰ ਦੇਖ ਕੇ ਬਹੁਤ ਹੀ ਵਧੀਆ ਲੱਗਿਆ ਅਤੇ ਆਪਾਂ ਉਹਨਾਂ ਦੇ ਵਿੱਚੋਂ ਕੋਈ ਸਮਾਨ ਕੁਝ ਸਮਾਨ ਆਪਾਂ ਖਰੀਦਿਆ ਵੀ ਅਤੇ ਜਿਹਦੀ ਉਹਨਾਂ ਨੇ ਉਹ ਆਪਣੇ ਹੱਥਾਂ ਦੇ ਬਣਾਏ ਹੋਏ ਸਮਾਨਾਂ ਦੇ ਆਪਣੇ ਕੀਮਤਾਂ ਵੀ ਬਹੁਤ ਹੀ ਘੱਟ ਲਗਾਈਆਂ ਹੋਈਆਂ ਸੀ ਜਿੱਦਾਂ ਕਿ ਬਹੁਤ ਸਾਰੇ ਉੱਥੇ ਲੋਕ ਆਏ ਅਤੇ ਉਹਨਾਂ ਨੂੰ ਖਰੀਦਿਆ ਜਿਹਦੇ ਕਰਕੇ ਉਹਨਾਂ ਨੂੰ ਉਹਨਾਂ ਦੀ ਕਲਾ ਦਾ ਬਹੁਤ ਵਧੀਆ ਮੁੱਲ ਉਹਨਾਂ ਦੀ ਕਲਾ ਦਾ ਮੁੱਲ ਪੈ ਗਿਆ